ਜਦੋਂ ਮੈਂ ਆਪਣਾ ਮੋਬਾਇਲ ਫੋਨ ਪ੍ਰਾਪਤ ਕੀਤਾ ਤਾਂ ਇਹ ਸ਼ੁੱਧ ਖੁਸ਼ੀ ਅਤੇ ਉਤਸ਼ਾਹ ਦਾ ਪਲ ਸੀ ਇਹ ਬੇਅੰਤ ਸੰਭਾਵਨਾਵਾਂ ਦੇ ਖਜ਼ਾਨੇ ਦੇ ਸੰਦੂਕ ਨੂੰ ਖੋਲ੍ਹਣ ਵਾਂਗ ਮਹਿਸੂਸ ਹੋਇਆ ਇਹ ਛੋਟਾ ਯੰਤਰ ਮੈਂ ਰੋਜ਼ਾਨਾ ਜੀਵਨ ਦਾ ਇੱਕ ਅਨਿੱਖੜ੍ਹਵਾਂ ਅੰਗ ਬਣ ਗਿਆ ਅਤੇ ਇਸ ਨੇ ਕਈ ਸਕਾਰਾਤਮਕ ਤਬਦੀਲੀਆਂ ਲਿਆਂਦੀਆਂ ਸਭ ਤੋਂ ਪਹਿਲਾਂ ਇਸ ਨੇ ਮੇਰੇ ਸੰਚਾਰ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ ਮੈਂ ਪਰਿਵਾਰ ਅਤੇ ਦੋਸਤਾਂ ਦੇ ਸੰਪਰਕ ਵਿੱਚ ਆਸਾਨੀ ਨਾਲ ਰਹਿ ਸਕਦਾ ਹਾਂ ਭਾਵੇਂ ਉਹ ਕਿਤੇ ਵੀ ਹੋਣ ਕਿੰਨੇ ਵੀ ਦੂਰ ਹੋਣ ਟੈਕਸਸ ਕਰਨ ਕਰਨਾ ਕਾਲ ਕਰਨਾ ਜਾਂ ਵੀਡਿਓ ਚੈਟਿੰਗ ਤੌਰ 'ਤੇ ਸੰਵਿਧਾਨਿਕ ਬਣ ਗਿਆ ਹੈ ਜਿਸ ਨਾਲ ਮੈਨੂੰ ਮੇਰੇ ਅਜ਼ੀਜ਼ਾਂ ਦੇ ਨੇੜੇ ਮਹਿਸੂਸ ਹੁੰਦਾ ਹੈ ਭਾਵੇਂ ਉਹ ਦੂਰ ਹੋਣ ਮੇਰੇ ਲਈ ਮੰਨੋਰੰਜਨ ਨੂੰ ਦੀ ਦੁਨੀਆਂ ਨੂੰ ਵੀ ਖੁੱਲ੍ਹ ਗਈ ਹੈ ਮੈਂ ਮਜ਼ੇਦਾਰ ਗੇਮ ਖੇਡ ਸਕਦਾ ਹਾਂ ਮੇਰਾ ਮਨ ਪਸੰਦ ਸੰਗੀਤ ਸੁਣ ਸਕਦਾ ਹਾਂ ਅਤੇ ਜਾਂਦੇ ਹੋਏ ਮੰਨੋਰੰਜਨ ਵੀਡਿਓ ਵੇਖ ਸਕਦਾ ਹਾਂ ਇਹ ਮੇਰੀ ਜੇਬ ਵਿੱਚ ਇੱਕ ਪੇਟਰੋਲ ਮੰਨੋਰੰਜਨ ਕੇਂਦਰ ਹੋਰ ਵਾਂਗ ਹੈ ਇਸ ਤੋਂ ਇਲਾਵਾ ਮੇਰਾ ਮੋਬਾਇਲ ਫੋਨ ਇੱਕ ਕੀਮਤੀ ਸਿਖ ਸਿੱਖਣ ਦੇ ਸਾਧਨ ਵਜੋਂ ਕੰਮ ਕਰਦਾ ਹੈ ਮੈਂ ਲੇਖਾਂ ਨੂੰ ਪੜ੍ਹਦਾ ਹਾਂ ਵਿੱਦਿਅਕ ਵੀਡਿਓ ਦੇਖਦਾ ਹਾਂ ਅਤੇ ਨਵੇਂ ਵਿਸ਼ਿਆਂ ਦੀ ਪੜਚੋਲ ਕਰਨ ਲਈ ਇੰਟਰਨੈੱਟ ਤੱਕ ਪਹੁੰਚ ਕਰ ਸਕਦਾ ਹਾਂ ਇਸ ਦੇ ਮੇਰੇ ਗਿਆਨ ਦਾ ਵਿਸਥਾਰ ਕੀਤਾ ਹੈ ਅਤੇ ਸਿੱਖਣ ਨੂੰ ਮਜ਼ੇਦਾਰ ਬਣਾ ਦਿੱਤਾ ਹੈ